ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਹੈ ਅਤੇ ਮੈਂ ਲਿਖਦਾ ਵੀ ਰਿਹਾ ਹਾਂ ਹੁਣ ਵੀ ਮੈਂ ਹੁਣ ਤੱਕ ਦੋ ਕਿਤਾਬਾਂ ਲਿਖ ਚੁੱਕਾ ਹਾਂ ਤੀਜੀ ਕਿਤਾਬ ਮੇਰੀ ਆਉਣ ਵਾਲੀ ਹੈ ਜੋ ਮੇਰੇ ਪਹਿਲੀ ਕਿਤਾਬ ਲਿਖੀ ਗਈ ਹੈ ਉਹ ਮੇਰੇ ਆਪਣੇ ਪਿੰਡ ਦੇ ਇਤਿਹਾਸ 'ਤੇ ਲਿਖੀ ਗਈ ਸੀ ਆਪਣੇ ਪਿੰਡ ਦੇ ਕਲਚਰ ਦੇ ਲਿਖੀ ਗਈ ਸੀ ਜਿਸਦਾ ਨਾਮ ਹੈ ਸਾਡਾ ਪਿੰਡ ਚਨਾਰਥਲ ਕਲਾਂ ਉਸ ਦੇ ਵਿੱਚ ਮੈਂ ਸਾਰਾ ਰਿਕਾਡ ਇਕੱਠਾ ਕਰਕੇ ਵੀ ਕਿੰਨਾ ਸਾਲ ਪੁਰਾਣਾ ਸਾਡਾ ਪਿੰਡ ਹੈ ਅਤੇ ਕਿਹੜੇ ਕਿਹੜੇ ਧਰਮ ਨਾਲ ਸੰਬੰਧਿਤ ਇੱਥੇ ਲੋਕ ਰਹਿੰਦੇ ਹਨ ਜਾਂ ਧਾਰਮਿਕ ਸਥਾਨ ਹਨ ਜਾਂ ਕੋਈ ਹੋਰ ਇਤਿਹਾਸ ਰਿਹਾ ਹੈ ਉਹ ਸਾਰਾ ਕਿਹੜਾ ਮੇਲਾ ਭਰਦਾ ਹੈ ਸਾਰਾ ਉਸਨੂੰ ਕਿਤਾਬ ਦੇ ਵਿੱਚ ਲਿਖ ਕੇ ਮੈਂ ਉਹ ਰਿਲੀਜ਼ ਕਰ ਚੁੱਕਿਆ ਹਾਂ ਤਕਰੀਬਨ ਉਹ ਡੇਢ ਸੌ ਪੇਜ ਦੀ ਕਿਤਾਬ ਸੀਗੀ ਉਸ ਤੋਂ ਬਾਅਦ ਸਾਡਾ ਪਿੰਡ ਭਾਗ ਦੂਜਾ ਵੀ ਕਿਤਾਬ ਮੈਂ ਛਾਪੀ ਸੀ ਉਸ ਦੇ ਵਿੱਚ ਦੱਸਿਆ ਗਿਆ ਸੀ ਜਿੱਦਾਂ ਪੁਰਾਣੇ ਆਜ਼ਾਦੀ ਘੁਲਾਟੀਏ ਕੌਣ ਸਨ ਜਿਨਾਂ ਨੇ ਮੋਰਚੇ ਲਾਏ ਉਹ ਕੌਣ ਸਨ ਅਤੇ ਹੋਰ ਵੀ ਜਿਵੇਂ ਕੋਈ ਪਿੰਡ ਦੇ ਵਿੱਚ ਨਹਿਰ ਪੱਟੀ ਗਈ ਉਹ ਕਦੋਂ ਪੱਟੀ ਗਈ ਕਿਵੇਂ ਉਹਨੂੰ ਕੀ ਕੀ ਔਕੜਾਂ ਆਈਆਂ ਕਿਹੜੇ ਕਿਹੜੇ ਕਿੱਸੇ ਪ੍ਰਚੱਲਿਤ ਨੇ ਕਿਹੜੀਆਂ ਧਾਰਮਿਕ ਕੁਝ ਸਮਾਧਾਂ ਜਾਂ ਹੋਰ ਚੀਜ਼ਾਂ ਬਣੀਆਂ ਉਸ ਸਭ ਬਾਰੇ ਮੈਂ ਉਸ ਦੇ ਵਿੱਚ ਦੱਸਿਆ ਗਿਆ ਹੈ